ਮੈਂ ਆਪਣੇ ਪੂਰੇ ਦਿਨ ਵਿੱਚ ਫੋਨ ਲੈਪਟਾਪ ਕੰਪਿਊਟਰ ਅਜਿਹੇ ਉਪਕਰਨ ਵਰਤਦੀ ਹਾਂ ਇਹਨਾਂ ਦੀ ਨਾ ਹੋਣ ਨਾਲ ਮੇਰੀ ਜ਼ਿੰਦਗੀ ਉਪਰ ਬਹੁਤ ਪ੍ਰਭਾਵ ਪਵੇਗਾ ਫੋਨ ਜੋ ਹਰ ਇੱਕ ਸੰਦੇਸ਼ ਭੇਜਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਇਲਾਵਾ ਕੰਪਿਊਟਰ ਲੈਪਟਾਪ ਉੱਪਰ ਮੈਂ ਫਾਈਲਾਂ ਤਿਆਰ ਕਰਦੀ ਹਾਂ ਜੇ ਇਹ ਟੈਕਨੋਲੋਜੀ ਨਾ ਹੋਵੇ ਤਾਂ ਮੈਨੂੰ ਫਾਈਲਾਂ ਤਿਆਰ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਵੇਗੀ ਇੰਟਰਨੈਟ ਨਾਲ ਸੰਬੰਧਿਤ ਮੇਰਾ ਕੰਮ ਟੈਕਨੋਲੋਜੀ ਤੋਂ ਬਿਨਾਂ ਅਧੂਰਾ ਹੈ ਹਰ ਇੱਕ ਦਫਤਰੀ ਕੰਮ ਦੇ ਵਿੱਚ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਫੋਨ ਇੰਟਰਨੈਟ ਲੈਪਟਾਪ ਉੱਪਰ ਹਰ ਕੰਮ ਬਹੁਤ ਆਸਾਨੀ ਨਾਲ ਅਤੇ ਤੇਜ਼ੀ ਨਾਲ ਕੀਤਾ ਜਾਂਦਾ ਹੈ ਜੇਕਰ ਇਹ ਉਪਕਰਨ ਨਾ ਹੋਣ ਤਾਂ ਇਹਨਾਂ ਨਾਲ ਅਸੀਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਾਂਗੇ ਇਹਨਾਂ ਤੋਂ ਬਿਨਾਂ ਸਾਡੀ ਸਮਾਂ ਵੀ ਬਰਬਾਦ ਹੋਵੇਗਾ ਟੈਕਨੋਲੋਜੀ ਦੀ ਮਦਦ ਨਾਲ ਸਾਡੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਸੀਂ ਇਹ ਸਭ ਕਰ ਸਕਦੇ ਹਾਂ